ਹੈਲੋ ਸਤਿ ਸ਼੍ਰੀ ਅਕਾਲ ਸਰ ਹੋਰ ਠੀਕ ਠਾਕ ਹੋ ਜੀ ਹਾਂਜੀ ਹਾਂਜੀ ਵਧੀਆ ਜੀ ਮੇਰਾ ਨਾ ਮੇਰਾ ਨਾ ਇੱਕ ਯੂਟਿਊਬ 'ਤੇ ਬਲੋਗ ਬਲੋਗਰ ਵਾਲਾ ਚੈਨਲ ਆ ਜੀ ਅਤੇ ਮੈਂ ਨਾ ਇੱਕ ਬਲੋਗ ਬਣਾਉਣਾ ਚਾਹੁੰਦਾ ਸੀਗਾ ਨਵਾਂਸ਼ਹਿਰ 'ਤੇ ਅਤੇ ਉਹਦਾ ਟੋਪਿਕ ਸੀਗਾ ਜਿਹੜੇ ਬੰਦੇ ਮਤਲਬ ਕਿ ਬੱਚੇ ਸਟੂਡੈਂਟ ਹੈ ਜਿਹੜੇ ਬਾਹਰ ਨੂੰ ਜਾ ਰਹੇ ਨੇ ਨਵਾਂਸ਼ਹਿਰ ਵਿੱਚ ਉਹਦਾ ਕੀ ਟ੍ਰੈਂਡ ਚੱਲ ਰਿਹਾ ਨਵਾਂਸ਼ਹਿਰ ਵਿੱਚ ਹਾਂਜੀ ਹਾਂਜੀ ਉਹ ਤਾਂ ਜ਼ਰੂਰ ਵੀ ਪਤਾ ਹੀ ਹੋਣਾ ਚਾਹੀਦਾ ਨੌਲੇਜ਼ ਬੰਦੇ ਨੂੰ ਇੰਨੀ ਕੁ ਤਾਂ ਹਾਂਜੀ ਅੱਛਾ ਜੀ ਉਹ ਕਾਹਦੇ ਹਾਂਜੀ ਹਾਂਜੀ ਹਾਂਜੀ ਹਮ ਹਮ

ਉਹ ਤਾਂ ਹੈ ਜੀ ਹਾਂ ਹਾਂਜੀ ਉਹ ਤਾਂ ਹੈ ਹਾਂਜੀ ਉਹ ਤਾਂ ਹੈ ਫਿਰ ਇੰਨੀ ਕੁ ਤਾਂ ਹੁਣ ਫ਼ਰਕ ਪੈਂਦਾ ਹੀ ਹੈ ਜੀ ਹਾਂਜੀ ਹਾਂਜੀ ਮੈਂ ਸੁਣਿਆ ਵੀ ਮੈਂ ਸੁਣਿਆ ਵੀ ਹਰ ਇੱਕ ਇੱਕ ਦੂਜੇ ਘਰ 'ਚੋ ਇੱਕ ਬੰਦਾ ਬਾਹਰ ਹੈ ਉਹ ਤਾਂ ਹੈ ਹੋਏ ਹਾਂਜੀ ਹਾਂਜੀ ਮੈਂ ਤਾਂ ਹੀ ਨਾ ਇਹਦੇ ਉੱਪਰ ਇੱਕ ਬਲੋਗ ਬਣਾਉਣਾ ਚਾਹੁੰਦਾ ਸੀਗਾ ਕੀ ਤੁਸੀਂ ਮੈਨੂੰ ਪਰਸੋਂ ਮਿਲ ਜਾਉਂਗੇ ਜੀ ਫਿਰ ਠੀਕ ਹੈ ਜੀ ਪਰਸੋਂ ਤੁਹਾਡੀ ਫਿਰ ਸ ਜਿਹੜੀ ਇਹ ਨੌਲੇਜ ਹੈ ਨਾ ਆਪਾਂ ਇੱਕ ਵੀਡਿਓ ਬਣਾ ਕੇ ਫਿਰ ਯੂਟਿਊਬ 'ਤੇ ਪਾਵਾਂਗੇ ਜੀ ਇਹਨੂੰ ਠੀਕ ਹੈ ਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਓਕੇ ਜੀ